ਮੈਂ ਇੱਕ ਕਿਤਾਬ ਜਿਹਦਾ ਨਾਂ ਪ੍ਰੀਤ ਕਹਾਣੀਆਂ ਪ੍ਰੀਤ ਕਹਾਣੀਆਂ ਦੇ ਵਿੱਚ ਸਭ ਪ੍ਰੇਮ ਕਰਨ ਵਾਲੇ ਜਿਹੜੇ ਸ਼ਖਸ ਅਤੇ ਜਿਸ ਤਰ੍ਹਾਂ ਕਿ ਹੀਰ ਰਾਂਝਾ ਸੱਸੀ ਪੁੰਨੂ ਲੈਲਾ ਮਜਨੂੰ ਇਹਨਾਂ ਵਿੱਚੋਂ ਸਾਰਿਆਂ ਦੇ ਜਿਹੜੇ ਜਿਹੜੇ ਪਿਆਰ ਕਰਨ ਵਾਲੇ ਨੇ ਇਹਨਾਂ ਦੀ ਪ੍ਰੀਤ ਕਹਾਣੀ ਦੇ ਵਿੱਚ ਨੇ ਸਾਰੀਆਂ ਲਿਖਤਾਂ ਨੇ ਉਹ ਮੈਂ ਬਾਰ ਬਾਰ ਪੜ੍ਹਦਾ ਹਾਂ ਜਿਸ ਤਰਾਂ ਸੱਸੀ ਪੁੰਨੂ ਦਾ ਹੈਗਾ ਸੱਸੀ ਪੁੰਨੂੰ ਦੋਸਤੀ ਹੋਏ ਜਾਤ ਅਜਾਤੀ ਰਾਂਝਾ ਹੀਰ ਵਖਾਣੀਐ ਇਕ ਪਿਰਮ ਪਰਾਤੀ ਮਹੀਵਾਲ ਨੂੰ ਸੋਹਣੀ ਨਾ ਤਰਦੀ ਰਾਤੀ ਇਹ ਸਾਰਿਆਂ ਦਾ ਵੇ ਹੈਡ ਜਿਹੜੇ ਬਣੇ ਹੋਏ ਨੇ ਇਹਨਾਂ ਦੀਆਂ ਇਹਨਾਂ ਤੋਂ ਫਿਲਮਾਂ ਵੀ ਬਣੀਆਂ ਹੋਈਆਂ ਸੱਸੀ ਪੁੰਨੁੰ ਬਣੀ ਏ ਹੀਰ ਰਾਂਝਾ ਬਣੀ ਹੈ ਸੋਹਣੀ ਮਹੀਂਵਾਲ ਬਣੀ ਏ ਇਹ ਸਾਰੀਆਂ ਫਿਲਮਾਂ ਵੀ ਦੇਖੀਆਂ ਨੇ ਅਤੇ ਇਹ ਕਿਤਾਬ ਹੈ ਬਾਰ ਬਾਰ ਇਹਨਾਂ ਦੀ ਪ੍ਰੇਮ ਕਥ ਕਹਾਣੀਆਂ ਦੀ ਪੜ੍ਹਦਾ ਵਾਂ ਅਤੇ ਜਿਹਦੇ ਨਾਲ ਮੈਨੂੰ ਸ਼ੌਂਕ ਯਾਦਗਾਰ ਹੈ ਅਤੇ ਐਹ ਵੀ ਜਿਹੜੇ ਪ੍ਰੀਤ ਕਹਾਣੀਆਂ ਦੇ ਪਹਿਰੇਦਾਰ ਹੋਏ ਨੇ ਇਹਨਾਂ ਦਾ ਬਹੁਤ ਦਿਲਚਸਪ ਕਹਾਣੀ ਹੈ